ਹਾਂਜੀ ਮੈਨੂੰ ਬਹੁਤ ਸਾਰੇ ਲੇਖਕ ਪਸੰਦ ਹਨ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਬਹੁਤ ਸਾਰੇ ਲੇਖਕਾਂ ਦੀਆਂ ਕਿਤਾਬਾਂ ਜਦੋਂ ਵੀ ਮੈਨੂੰ ਮੌਕਾ ਮਿਲਦਾ ਮੈਂ ਪੜ੍ਹਦੀ ਰਹਿੰਦੀ ਹੈਗੀ ਹਾਂ ਉਹਦੇ 'ਚ ਇੱਕ ਲੇਖਕ ਮਾਨਯੋਗ ਆਪਣੇ ਸੁਰਜੀਤ ਪਾਤਰ ਜੀ ਹਨ ਅਤੇ ਉਹਨਾਂ ਦੀਆਂ ਮੈਂ ਬਹੁਤ ਸਾਰੀਆਂ ਕਿਤਾ ਕਿਤਾਬਾਂ ਵਿੱਚ ਕਵਿਤਾਵਾਂ ਵਗੈਰਾ ਪੜ੍ਹੀਆਂ ਜਿਹੜੀਆਂ ਮੈਨੂੰ ਵੀ ਵਧੀਆ ਲੱਗੀਆਂ ਅਤੇ ਹੋ ਮੈਂ ਹੋਰ ਇੱਕ ਮੇਰੇ ਮਨਪਸੰਦ ਲੇਖਕ ਹਨ ਵਿਸ਼ੇ ਵਿਸ਼ੇਸ਼ ਰੂਪ 'ਚ ਹਾਰ ਹਰ ਪਲ ਲੀ ਉਹਨਾਂ ਨੇ ਵਿਗਿਆਨ ਦੇ ਬਾਰੇ ਪ੍ਰਕਾਸ਼ ਦੀ ਦ ਵਿਗਿਆਨ ਦੇ ਬਾਰੇ 'ਚ ਉਹਨਾਂ ਨੇ ਲਿਖੀਆਂ ਹੈਗੀਆਂ ਕਿਤਾਬਾਂ ਜਿਹਦੇ 'ਚ ਵਿਗਿਆਨ ਦਾ ਆਪਾਂ ਨੂੰ ਗਿਆਨ ਮਿਲਦਾ ਹੈਗਾ ਵਿਗਿਆਨ ਪ੍ਰਕਾਸ਼ ਦੀ ਦੁਨੀਆਂ ਨੂੰ ਰੌਸ਼ਨੀ ਵਿੱਚ ਲਿਆ ਚੁੱਕੇ ਹਨ ਉਹ ਉਹਨਾਂ ਦੀਆਂ ਲਿਖਿਤ ਪੜ੍ਹਨ ਦੇ ਬਾਅਦ ਮੈਨੂੰ ਉਹਨਾਂ ਦੀ ਸੋਚ ਅਤੇ ਉਹਨਾਂ ਦੇ ਅਨੁਭਵਾਂ ਦਾ ਨੂੰ ਸਮਝਣ ਦਾ ਮੌਕਾ ਮਿਲਿਆ ਹੈਗਾ ਉਹਨਾਂ ਦੀ ਸ ਅਤੇ ਮੈਨੂੰ ਵਿਗਿਆਨ ਦੀਆਂ ਬਹੁਤ ਸਾਰੀਆਂ ਜਾਣਕਾਰੀਆਂ ਮਿਲੀਆਂ ਹਨ ਜਿਹੜੀਆਂ ਮੈਨੂੰ ਪਤਾ ਨਹੀਂ ਸੀਗੀਆਂ ਅਤੇ ਜੇ ਆਪਾਂ ਨੇ ਪੜ੍ਹਨ ਤੋਂ ਬਾਅਦ ਪੜ੍ਹਨ ਤੋਂ ਬਾਅਦ ਹੀ ਆਪਣੀ ਨੌਲੇਜ ਵਧਦੀ ਹੈ ਜਿਵੇਂ ਜਿਵੇਂ ਆਪਾਂ ਪੜ੍ਹਦੇ ਹਾਂ ਆਪਣੀ ਉਵੇਂ ਨੌਲੇਜ ਵਧਦੀ ਹੈਗੀ ਹੈ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਪੜ੍ਹੀਆਂ ਮੈਨੂੰ ਵਿਸਤਾਰਿਤ ਰੂਪ ਵਿੱਚ ਸਮਝਣ ਦਾ ਬਹੁ ਬਹੁਤ ਮੌਕਾ ਮਿਲਿਆ ਅਤੇ ਮੈਨੂੰ ਬਹੁਤ ਉਹ ਮੇਰੇ ਬਹੁਤ ਮਨਪਸੰਦ ਲੇਖਕ ਹਨ ਉਹਨਾਂ ਨੂੰ ਮੈਂ ਜ ਵਿਗਿਆਨ ਦੇ ਬਾਰੇ 'ਚ ਉਹਨਾਂ ਨੇ ਦੁਨੀਆਂ ਵਿੱਚ ਕਿਵੇਂ ਰੌਸ਼ਨੀ ਹੋਈ ਵਿਗਿਆਨ ਨਾਲ ਅਤੇ ਬਹੁਤ ਸਾਰਾ ਕੁਛ ਉਹਨਾਂ ਨੇ ਦੱਸਿਆ ਹੋਇਆ ਉਹਦੇ ਵਿੱਚ